ਮੈਂ ਫੋਟੋਗ੍ਰਾਫੀ ਕਰਨ ਦਾ ਬਹੁਤ ਸ਼ੌਕੀਨ ਹਾਂ ਅਤੇ ਮੇਰੇ ਘਰ ਦੇ ਮੇਰੇ ਇਸ ਸ਼ੌਂਕ ਨੂੰ ਲੈ ਕੇ ਮੈਨੂੰ ਕਾਫੀ ਸਮਰਥਨ ਦਿੰਦੇ ਹਨ ਉਹਨਾਂ ਨੇ ਆਪਣਾ ਸਮਰਥਨ ਜਤਾਉਂਦੇ ਹੋਏ ਮੈਨੂੰ ਇੱਕ ਨਿਕਾਉਣ ਦਾ ਡੀ ਐਸ ਏਲ ਆਰ ਕੈਮਰਾ ਲਿਆ ਕੇ ਦਿੱਤਾ ਜਿਹਦੇ ਨਾਲ ਹੁਣ ਮੈਂ ਫੋਟੋਗ੍ਰਾਫੀ ਕਰਦਾ ਹਾਂ ਅਤੇ ਫੋਟੋਗ੍ਰਾਫੀ ਸਿਰਫ ਇੱਕ ਤਸਵੀਰ ਨੂੰ ਖਿੱਚਣ ਦਾ ਕੰਮ ਨਹੀਂ ਕਰਦੀ ਹੈ ਇਹ ਇੱਕ ਪੂਰੀ ਕਹਾਣੀ ਨੂੰ ਬਿਆਨ ਕਰਦੀ ਹੈ ਕਿ ਉਸ ਤਸਵੀਰ ਪਿੱਛੇ ਦੀ ਕਹਾਣੀ ਕੀ ਹੈ ਤਾਂ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕਿ ਮੈਂ ਕਿਵੇਂ ਆਪਣਾ ਇੱਕ ਪੂਰਾ ਦਿਨ ਆਪਣੇ ਸ਼ੌਂਕ ਨੂੰ ਪੂਰਾ ਕਰਨ ਲਈ ਫੋਟੋਗ੍ਰਾਫੀ ਮੈਂ ਕਿੱਥੇ ਜਾ ਕੇ ਕੀਤੀ ਤਾਂ ਸਵੇਰ ਦਾ ਸਮਾਂ ਸੀ ਮੈਂ ਆਪਣਾ ਪੂਰਾ ਬਸਤਾ ਤਿਆਰ ਕੀਤਾ ਅਤੇ ਮੇਰੇ ਘਰਦਿਆਂ ਨੇ ਜਿਹੜਾ ਮੈਨੂੰ ਕੈਮਰਾ ਲਿਆ ਕੇ ਦਿੱਤਾ ਸੀ ਉਹ ਲੈ ਕੇ ਮੈਂ ਇੱਕ ਪਹਾੜਾਂ ਦੇ ਇਲਾਕੇ 'ਚ ਗਿਆ ਜੋ ਕਿ ਮੇਰੇ ਘਰ ਦੇ ਲਾਗੇ ਹੀ ਹੈ ਮੈਂ ਕੁੱਲੂ ਮਨਾਲੀ ਵੱਲ ਗਿਆ ਸੀ ਅਤੇ ਉੱਥੇ ਮੈਂ ਸਵੇਰੇ ਸੂਰਜ ਚੜਦੇ ਹੋਏ ਦੀ ਫੋਟੋ ਖਿੱਚੀ ਅਤੇ ਉਸ ਵੇਲੇ ਕਾਫ਼ੀ ਸਾਰੇ ਦਰਖਤ ਉੱਤੇ ਧੁੱਪ ਪੈ ਰਹੀ ਸੀ ਅਤੇ ਕਾਫ਼ੀ ਸੋਹਣੀ ਤਸਵੀਰ ਆਈ ਅਤੇ ਇਹ ਸੋਹਣੀ ਤਸਵੀਰ ਸਵੇਰ ਦੇ ਸਮੇਂ ਨੂੰ ਬਿਆਨ ਕਰਦੀ ਹੈ ਕਿ ਕਿਸ ਤਰੀਕੇ ਨਾਲ ਕਿ ਸੂਰਜ ਇੱਕ ਪਾਸਿਓਂ ਚੜਦਾ ਹੈ ਅਤੇ ਦੂਜੇ ਪਾਸੇ ਨੂੰ ਅਸਥ ਹੁੰਦਾ ਹੈ ਉਸ ਤੋਂ ਬਾਅਦ ਮੈਂ ਕਾਫ਼ੀ ਸਾਰੀ ਨਹਿਰਾਂ ਦੀ ਵੀ ਤਸਵੀਰਾਂ ਖਿੱਚੀਆਂ ਜੋ ਕਿ ਸਾਡੇ ਸਾਫ਼ ਪਾਣੀ ਨੂੰ ਦਰਸਾਉਂਦੀ ਹੈ ਅਤੇ ਸ਼ਾਮ ਵੇਲੇ ਮੈਂ ਸੂਰਜ ਡੁੱਬਦੇ ਹੋਏ ਦੀ ਫੋਟੋ ਖਿੱਚੀ ਜਿਸ ਨਾਲ ਪਤਾ ਚੱਲਦਾ ਹੈ ਕਿ ਸਾਡਾ ਦਿਨ ਕਿਵੇਂ ਸਮਾਪਤ ਹੋ ਰਿਹਾ ਹੈ ਇਸ ਦੇ ਨਾਲ ਨਾਲ ਸ਼ਾਮ ਨੂੰ ਮੈਂ ਘਰ ਵਾਪਸ ਆਉਣ ਦੀ ਤਿਆਰੀ ਵੀ ਕੀਤੀ ਅਤੇ ਮੈਂ ਘਰ ਵਾਪਸ ਆ ਕੇ ਚੰਨ ਦੀ ਫੋਟੋ ਖਿੱਚੀ ਅਤੇ ਚੰਨ ਸਾਨੂੰ ਬਿਆਨ ਕਰਦਾ ਹੈਗੀ ਕਿ ਕਿਵੇਂ ਸਾਡੀ ਰਾਤ ਕਾਫੀ ਸੁਹਾਵਣੀ ਹੈ ਅਤੇ ਇਹ ਚੰਦ ਦੀ ਚਾਨਣੀ ਵਿੱਚ ਤਾਰੇ ਕਿੱਦਾਂ ਚਮਕਦੇ ਹਨ ਇਹ ਸਾਰੀਆਂ ਤਸਵੀਰਾਂ ਖਿੱਚ ਕੇ ਮੈਨੂੰ ਕਾਫ਼ੀ ਵਧੀਆ ਲੱਗਾ ਅਤੇ ਮੈਂ ਆਪਣੇ ਘਰਦਿਆਂ ਨੂੰ ਇਹ ਤਸਵੀਰਾਂ ਦਿਖਾਈਆਂ ਉਹ ਹਿਕ ਇਹ ਤਸਵੀਰਾਂ ਨੂੰ ਦੇਖ ਕੇ ਖਾ ਕਾਫ਼ੀ ਖੁਸ਼ ਸੀ ਅਤੇ ਉਹਨਾਂ ਨੇ ਇਸ ਦੇ ਨਾਲ ਕਾਫ਼ੀ ਸਮਰਥਨ ਦਿਖਾਇਆ